ਭੰਗੜਾ ਪੰਜਾਬ ਦਾ ਇੱਕ ਮੁੱਖ ਲੋਕ ਨਾਚ ਹੈ ਪੰਜਾਬੀ ਸੱਭਿਆਚਾਰ ਦਾ ਇੱਕ ਮੁੱਖ ਅੰਗ ਬਣ ਚੁੱਕਾ ਹੈ ਪੰਜਾਬੀ ਆਪਣੀ ਹਰ ਖੁਸ਼ੀ ਭੰਗੜਾ ਪਾ ਕੇ ਹੀ ਮਨਾਉਂਦੇ ਹਨ ਭਾਵੇਂ ਉਹ ਵਿਆਹ ਹੋਵੇ ਜਾਂ ਮੁੰਡੇ ਜਾਂ ਕੁੜੀ ਦਾ ਜਨਮਦਿਨ ਹੋਵੇ ਪੰਜਾਬੀਆਂ ਦੇ ਸਾਰੇ ਹੀ ਤਿਉਹਾਰ ਅਤੇ ਪਾਰਟੀਆਂ ਭੰਗੜੇ ਤੋਂ ਬਿਨਾਂ ਅਧੂਰੇ ਹਨ ਪੁਰਾਣੇ ਸਮੇਂ ਤੋਂ ਹੀ ਕਣਕ ਦੀ ਕਟਾਈ ਕਰਕੇ ਘਰ ਵਿੱਚ ਨਵੀਂ ਕਣਕ ਅਤੇ ਪੈਸੇ ਆਉਣ ਦੀ ਖੁਸ਼ੀ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਸੀ ਉਸ ਸਮੇਂ ਤੋਂ ਇਸ ਤਿਉਹਾਰ ਵਿੱਚ ਖੁਸ਼ੀ ਵਜੋਂ ਵੀ ਭੰਗੜਾ ਪਾਇਆ ਜਾਂਦਾ ਹੈ ਅੱਜ ਕੱਲ੍ਹ ਭੰਗੜੇ ਦੇ ਮੁਕਾਬਲੇ ਵੀ ਹੋਣ ਲੱਗ ਪਏ ਹਨ ਸਕੂਲਾਂ ਕਾਲਜਾਂ ਵਿੱਚ ਭੰਗੜੇ ਦੀਆਂ ਟੀਮਾਂ ਹਨ ਅਤੇ ਭੰਗੜੇ ਦੇ ਕੋਚ ਹੁੰਦੇ ਹਨ ਅੱਜ ਕੱਲ੍ਹ ਪੰਜਾਬ ਦੇ ਹਰੇਕ ਤਿਉਹਾਰ ਅਤੇ ਖੁਸ਼ੀ ਦੇ ਮੌਕੇ ਵਿੱਚ ਭੰਗੜਾ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਆਮ ਤੌਰ 'ਤੇ ਪੰਜਾਬੀ ਸੱਭਿਆਚਾਰ ਦੇ ਲੋਕ ਗੀਤ ਵੀ ਭੰਗੜੇ ਦਾ ਮੁੱਖ ਅੰਗ ਹੋਣ ਕਰਕੇ ਭੰਗੜੇ ਇਸ ਗੀਤ ਦੇ ਨਾਲ ਨਾਲ ਪਾਏ ਜਾਂਦੇ ਹਨ ਅਤੇ ਗੀਤ ਦੀ ਉਸ ਤੁਕਬੰਦੀ ਨੂੰ ਚਾਰ ਚੰਦ ਲਾਉਂਦੇ ਹਨ ਭੰਗੜੇ ਦਾ ਰਸ ਬਹੁਤ ਸੁੰਦਰ ਵੀ ਹੁੰਦਾ ਹੈ ਜੋ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਆਮ ਤੌਰ 'ਤੇ ਪੰਜਾਬੀ ਸੱਭਿਆਚਾਰ ਦਾ ਭੰਗੜਾ ਇੱਕ ਮੁੱਖ ਅੰਗ ਬਣ ਚੁੱਕਾ ਹੈ ਜੇਕਰ ਕੋਈ ਵੀ ਇਤਿਹਾਸਿਕ ਜਾਂ ਪੁਰਾਣੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਉਸ ਵਿੱਚ ਪੰਜਾਬੀਆਂ ਦਾ ਮੁੱਖ ਅੰਗ ਭੰਗੜਾ ਹੀ ਬਣ ਚੁੱਕਾ ਹੈ